ਮੈਂ ਵਿਜੇ ਗੁਰਦਾਸਪੁਰ ਜਿਲੇ ਦਾ ਰਹਿਣ ਵਾਲਾ ਹਾਂ ਮੈਂ ਅੱਜ ਦੱਸਣਾ ਚਾਹੁੰਦਾ ਹਾਂ ਕੀ ਜੋ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਏਮ ਜਾਂ ਨਿਸ਼ਾਨਾ ਮਿਥ ਕੇ ਚਲਦੇ ਹਨ ਉਹਨਾਂ ਦੀ ਗੱਲ ਕਰਨ ਨਹੀਂ ਦਿੱਤਾ ਹਾਂ ਕੀ ਕੁਝ ਇਨਸਾਨ ਅਜਿਹੇ ਅਸੀਂ ਸੁਣਦੇ ਹਾਂ ਜਾਂ ਦੇਖਦੇ ਹਾਂ ਜਿਹੜੇ ਕਿ ਜ਼ਿੰਦਗੀ ਵਿੱਚ ਕੋਈ ਨਾ ਕੋਈ ਸਟੈਂਪ ਇਕੱਠੀਆਂ ਕਰਦੇ ਹਨ ਜਿਵੇਂ ਵੱਖਰੇ ਵੱਖਰੇ ਰਾਜ ਦੀਆਂ ਸਟੈਂਪਾਂ ਜਾਂ ਵੱਖਰੇ ਵੱਖਰੇ ਦੇਸ਼ਾਂ ਦੀਆਂ ਸਟੈਂਪਾਂ ਜਾਂ ਵੱਖਰੇ ਵੱਖਰੇ ਇਲਾਕੇ ਦੀਆਂ ਸਟੈਂਪਾਂ ਇਸੇ ਤਰ੍ਹਾਂ ਕਈ ਲੋਕੀ ਪੁਰਾਣੇ ਸਿੱਕਿਆਂ ਨੂੰ ਇਕੱਠਾ ਕਰਦੇ ਹਨ ਜਦੋਂ ਕਿ ਪੁਰਾਣੇ ਸਮੇਂ ਵਿੱਚ ਰਾਜੇ ਮਹਾਰਾਜੇ ਹੁੰਦੇ ਸੀ ਤੇ ਉਹਨਾਂ ਦੇ ਸਿੱਕਿਆ ਉੱਪਰ ਉਹਨਾਂ ਦੀ ਤਸਵੀਰ ਚਿਤਰਨ ਕੀਤੀ ਹੁੰਦੀ ਸੀ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਅਸੀਂ ਸੁਣਦੇ ਹਾਂ ਮਲਕਾ ਦੀ ਮਲਕਾ ਦੀ ਫੋਟੋ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹਨਾਂ ਦੇ ਉੱਪਰ ਸਿੱਕਿਆਂ ਦੀ ਫੋਟੋ ਜਾਂ ਹੋਰ ਪੁਰਾਤਨ ਸਮੇਂ ਵਿੱਚ ਸਿੱਧੂ ਘਾਟੀ ਦੇ ਸੱਭਿਅਤਾ ਦੇ ਸਮੇਂ ਜੋ ਸਿੱਕੇ ਸਨ ਉਹਨਾਂ ਉੱਤੇ ਉਸ ਸਮੇਂ ਦੇ ਲੋਕਾਂ ਦੀ ਰਾਜਿਆਂ ਮਹਾਰਾਜਿਆਂ ਦੀਆਂ ਫੋਟੋਆਂ ਇਕੱਠੀਆਂ ਹੁੰਦੀਆਂ ਸੀ ਇਸ ਤਰ੍ਹਾਂ ਕੁਝ ਲੋਕੀ ਪੱਥਰਾਂ ਨੂੰ ਇਕੱਠਾ ਕਰਦੇ ਹਨ ਕੁਝ ਗੋਲ ਪੱਥਰ ਚੁੱਕਦੇ ਹਨ ਤੇ ਆਪਣੀ ਘਰ ਦੀ ਸ਼ਿੰਗਾਰਨ ਲਈ ਆਪਣੀ ਅਲਮਾਰੀ ਵਿੱਚ ਸਾਂਭ ਕੇ ਰੱਖਦੇ ਹਨ ਉਹਨਾਂ ਦਾ ਮੇਨ ਮਕਸਦ ਹੁੰਦਾ ਹੈ ਕਿ ਪੱਥਰਾਂ ਨੂੰ ਵੀ ਸਾਂਭ ਕੇ ਰੱਖਿਆ ਜਾਏ ਜਾਂ ਇਹਨਾਂ ਨੂੰ ਵਧੀਆ ਤਰ੍ਹਾਂ ਨਾਲ ਚਿਤਰਨ ਕੀਤਾ ਜਾਏ ਇਸ ਤਰ੍ਹਾਂ ਮੈਂ ਦੱਸਦਾ ਹਾਂ ਕਿ ਆਪਣੀ ਆਪਣੀ ਜੋ ਵੀ ਸਮਝਦਾਰੀ ਹੈ ਉਸ ਮੁਤਾਬਿਕ ਸਾਨੂੰ ਕੋਈ ਨਾ ਕੋਈ ਨਿਸ਼ਾਨਾ ਮਿੱਥ ਕੇ ਤੇ ਉਸ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਧੰਨਵਾਦ